ਹੈਲੋ ਹਾਂਜੀ ਮੈਮ ਮੇਰਾ ਨਾਮ ਰੀਆ ਸ਼ਰਮਾ ਹੈ ਤੁਸੀਂ ਰੰਜਨਾ ਸ਼ਰਮਾ ਗੱਲ ਕਰ ਰਹੇ ਹੋ ਮੈਨੂੰ ਨਾ ਤੁਹਾਡਾ ਨੰਬਰ ਦਿੱਤਾ ਸੀ ਕਿਸੇ ਨੇ ਮੈਨੂੰ ਤੁਹਾਡੇ ਤੋਂ ਕੁਛ ਪੁੱਛਣਾ ਸੀ ਕੋਲਿਜ ਬਾਰੇ ਐਕਚੁਲੀ ਮੈਂ ਹਰਿਆਣੇ ਤੋਂ ਬਿਲੋਂਗ ਕਰਦੀ ਹਾਂ ਅਤੇ ਮੈਨੂੰ ਇੱਥੇ ਪੰਜਾਬ 'ਚ ਸ਼ਿਫਟ ਹੋ ਹੋਈ ਹਾਂ ਮੈਂ ਹੁਣੇ ਰੀਸੈਂਟਲੀ ਤਾਂ ਮੈਨੂੰ ਇੱਥੇ ਕੋਲਿਜ 'ਚ ਐਡਮਿਸ਼ਨ ਲੈਣੀ ਹੈ ਬੀ ਸੀ ਏ ਦੇ ਬੀ ਸੀ ਏ ਕੋਰਸ ਲਈ ਤਾਂ ਤੁਸੀਂ ਮੈਨੂੰ ਕੋਲਿਜ ਬਾਰੇ ਥੋੜ੍ਹੀ ਨੋਲੇਜ ਦੇ ਦੋਵੋਗੇ ਕੋਈ ਯੂਨੀਵਰਸਿਟੀ ਕਿਵੇਂ ਇੱਥੇ ਬੈਸਟ ਹੈ ਜਿੱਥੇ ਮੈਂ ਐਡਮਿਸ਼ਨ ਲੈ ਸਕਾਂ ਗੌਰਮੈਂਟ 'ਚ ਕਰਨਾ ਮੈਂ ਓਕੇ ਹਾਂਜੀ ਫੀਸ ਵਗੈਰਾ ਦਾ ਕਿਵੇਂ ਅੱਛਾ ਓਕੇ ਓਕੇ ਅਤੇ ਇਸ ਤੋਂ ਇਲਾਵਾ ਕੋਈ ਹੋਰ ਕੋਲਿਜ ਓਕੇ ਅਤੇ ਐੱਨ ਸੀ ਸੀ ਦੇ ਕੋਰਸ ਲਈ ਵੀ ਪੁੱਛਣਾ ਸੀ ਨਾਲ ਹੀ ਉਸ ਕੋਲਿਜ 'ਚ ਮਿਲ ਜੂਗੀ ਜਿਹੜੇ ਤੁਸੀਂ ਛੇ ਫੇਸ ਬਾਰੇ ਦੱਸ ਰਹੇ ਹੋ ਓਕੇ ਹਾਂਜੀ ਓਕੇ ਓਕੇ ਅੱਛਾ ਠੀਕ ਹੈ ਹਾਂਜੀ ਹਾਂਜੀ ਓਕੇ ਜਿਵੇਂ ਮੈਂ ਸਕੂਲ 'ਚ ਵੀ ਐੱਨ ਸੀ ਸੀ ਲਿਤੀ ਸੀ ਉਹਦਾ ਵੀ ਕੋਈ ਥੋੜ੍ਹਾ ਬੈਨੀਫਿਟ ਹੋਏਗਾ ਹਾਂਜੀ ਹਾਂਜੀ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਓਕੇ ਮੈਮ ਥੈਂਕ ਯੂ